ਪਿੰਡ ਵਿੱਚ ਕਿਸੇ ਵਿਅਕਤੀ ਦੇ ਕੁੱਤੇ ਦੇ ਕੱਟਣ 'ਤੇ ਸਾਡੇ ਪਿੰਡ ਵਿੱਚ ਸਭ ਤੋਂ ਪਹਿਲਾਂ ਜੋ ਕਿ ਘਰੇਲੂ ਉਪਚਾਰ ਕੀਤਾ ਜਾਂਦਾ ਹੈ ਉਸ ਵਿੱਚ ਸਭ ਤੋਂ ਪਹਿਲਾਂ ਜਖਮ ਨੂੰ ਸਾਫ਼ ਕੀਤਾ ਜਾਂਦਾ ਹੈ ਕਿਸੇ ਵੀ ਐਂਟੀਸੈਪਟਿਕ ਨਾਲ ਡਿਟੋਲ ਜਾਂ ਹਾਈਡ੍ਰੋਜਨ ਪਾ ਕੇ ਫਿਰ ਉਸ 'ਤੇ ਸਰੋਂ ਦਾ ਤੇਲ ਅਤੇ ਹਲਦੀ ਮਿਕਸ ਕਰਕੇ ਲਗਾ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਪਿੰਡ ਵਿੱਚ ਮੁੱਢਲੀ ਸਹਾਇਤਾ ਲਈ ਡਾਕਟਰ ਦੇ ਕੋਲ ਲੈ ਕੇ ਜਾਂਦੇ ਹਾਂ ਜਿੱਥੇ ਡਾਕਟਰ ਜਖਮ ਨੂੰ ਸਾਫ਼ ਕਰਕੇ ਦਵਾਈ ਲਵਾ ਲਗਾ ਕੇ ਮੱਲਮ ਪੱਟੀ ਕਰ ਦਿੰਦੇ ਹਨ ਅਤੇ ਖਾਣ ਵਾਸਤੇ ਦਵਾਈ ਅਤੇ ਇੰਜੈਕਸ਼ਨ ਲਗਾਉਂਦੇ ਹਨ ਅਗਰ ਕੁੱਤਾ ਹਲਕਿਆ ਹੋਵੇ ਤਾਂ ਸ਼ਹਿਰ ਦੇ ਹਸਪਤਾਲ ਵਿੱਚ ਜਾ ਕੇ ਲੋੜੀਂਦੇ ਟੈਸਟ ਆਦਿ ਕਰਵਾਏ ਜਾਂਦੇ ਹਨ ਅਤੇ ਉਸ ਦਾ ਇਲਾਜ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾਂਦਾ ਹੈ ਅਤੇ ਇੰਜੈਕਸ਼ਨ ਲਗਾਏ ਜਾਂਦੇ ਹਨ